ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੇ ਹਾਂ ਅੱਛਾ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਕਿਹੜੇ ਮੰਨਥ ਵਿੱਚ ਆਉਣਾ ਅੱਛਾ ਜੀ ਤੁਸੀਂ ਮਤਲਬ ਨੈਕਸਟ ਮੰਨਥ ਆ ਰਹੇ ਹੋ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ ਅਜੇ ਇਸ ਤਰ੍ਹਾਂ ਹੈ ਕਿ ਸਾਰੇ ਪੰਜਾਬ ਵਿੱਚ ਜਿਹੜਾ ਮੌਸਮ ਹੈ ਉਹ ਆਪਣੇ ਕੋਲ ਸਰਦੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਹਾਂਜੀ ਸਰਦੀ ਦਾ ਮੌਸਮ ਹੋਏਗਾ ਦਸੰਬਰ ਦੇ ਵਿੱਚ ਦਸੰਬਰ ਐਂਡ ਤੱਕ ਧੁੰਦ ਪੈਣ ਲੱਗ ਜਾਂਦੀ ਹੈ ਇੱਥੇ ਅਤੇ ਹਾਂਜੀ ਨਹੀਂ ਨਹੀਂ ਨਹੀਂ ਇੱਥੇ ਇ ਨਾ ਨਾ ਨਾ ਇਸ ਤਰਾਂ ਨਹੀਂ ਹੈਗਾ ਤੁਸੀਂ ਇੱਕ ਦਿਨ ਦਾ ਹੀ ਜਿਹੜਾ ਇੱਥੇ ਟ੍ਰਿਪ ਰੱਖ ਸਕਦੇ ਆ ਆਪਣਾ ਇ ਹਾਂਜੀ ਇੱਕ ਦਿਨ ਦੇ ਵਿੱਚ ਹੀ ਤੁਸੀਂ ਫਤਿਹਗੜ੍ਹ ਸਾਹਿਬ ਦੇ ਵਿੱਚ ਆ ਕੇ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਅਤੇ ਮੌਸਮ ਦੀ ਜੇ ਮੈਂ ਗੱਲ ਕਰਾਂ ਤਾਂ ਮੌਸਮ ਇਸ ਤਰ੍ਹਾਂ ਹੈ ਕਿ ਦਸੰਬਰ ਦੇ ਵਿੱਚ ਤਾਂ ਜਦੋਂ ਦੇਖੋ ਕੋਟੀਆਂ ਸਵੈਟਰਸ ਵਗੈਰਾ ਪੈਣ ਲੱਗ ਜਾਂਦੇ ਆ ਅਤੇ ਜਿਵੇਂ ਤੁਸੀਂ ਜੇ ਆਉਣਾ ਹੈ ਨਾ ਤਾਂ ਆਪਣਾ ਥੋੜ੍ਹਾ ਜਿਹਾ ਇੰਤਜ਼ਾਮ ਇਸ ਚੀਜ਼ ਦਾ ਕਰਕੇ ਰੱਖਿਓ ਅਤੇ ਨਾਲ ਹੀ ਜਿਵੇਂ ਧੁੰਦ ਵਗੈਰਾ ਜੇ ਹੁੰਦੀ ਆ ਤਾਂ ਤੁਸੀਂ ਆਪਣਾ ਜਿਹੜਾ ਜਿਵੇਂ ਸਵੇਰ ਦੇ ਟਾਈਮ 'ਤੇ ਜ਼ਿਆਦਾ ਧੁੰਦ ਹੋ ਜਾਂਦੀ ਹੈ ਜਾਂ ਰਾਤ ਲੇਟ ਨਾਈਟ ਦਾ ਜਿਹੜਾ ਸਫਰ ਹੈ ਹੈ ਨਾ ਉਹ ਔਖਾ ਹੁੰਦਾ ਤਾਂ ਇਸ ਕਰਕੇ ਹਾਂ ਹਾਂ ਸਟੇਅ ਤੁਸੀਂ ਕਰ ਸਕਦੇ ਹੋ ਇੱਥੇ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਸਰਾਵਾਂ ਬਣੀਆਂ ਹੋਈਆਂ ਨੇ ਉੱਥੇ ਤੁਸੀਂ ਸਟੇਅ ਕਰ ਸਕਦੇ ਹੋ ਬਸ ਇਹ ਹੈ ਕਿ ਤੁਸੀਂ ਆਪਣਾ ਉਹਦੇ ਹਿਸਾਬ ਦੇ ਨਾਲ ਇੱਕ ਤਾਂ ਕੱਪੜਿਆਂ ਦਾ ਧਿਆਨ ਰੱਖਣਾ ਹੈ ਜੇ ਤੁਸੀਂ ਸਟੇਅ ਵਗੈਰਾ ਕਰਨੀ ਹੈ ਤਾਂ ਵੀ ਤੁਸੀਂ ਆਪਣੇ ਕੰਬਲ ਵਗੈਰਾ ਨਾਲ ਲੈ ਕੇ ਆਇਓ ਠੰਡ ਦਾ ਮੌਸਮ ਹੋਏਗਾ ਹਾਂਜੀ ਹਾਂ ਇੱਕ ਜੋਤੀ ਸਰੂਪ ਜੋਤੀ ਸਰੂਪ ਸਾਹਿਬ ਹੈ ਉਹ ਵੀ ਨੇੜੇ ਹੀ ਆ ਦੋਵਾਂ ਦਾ ਡਿਸਟੈਂਸ ਜਿਹੜਾ ਹੈ ਆਪਣੇ ਸਟੇਸ਼ਨ ਤੋਂ ਮੈਨੂੰ ਲੱਗਦਾ ਕਿ ਬਹੁਤ ਤੁਹਾਨੂੰ ਪੰਜ ਸੱਤ ਮਿੰਟ ਹੀ ਲੱਗਣਗੇ ਗੁਰਦੁਆਰਿਆਂ ਵਿੱਚ ਜਾਣ ਦੇ ਹਾਂਜੀ ਹਾਂਜੀ ਹਾਂਜੀ ਉਹ ਵੀ ਨਾਲ ਹੀ ਆ ਫਤਿਹਗੜ੍ਹ ਸਾਹਿਬ ਦੇ ਨਾਲ ਹੀ ਗੁਰਦੁਆਰੇ ਜਿਹੜੇ ਨੇ ਉਹ ਬਣੇ ਹੋਏ ਨੇ ਅਤੇ ਕੋਈ ਨਹੀਂ ਤੁਸੀਂ ਆਪਣਾ ਜਿਹੜਾ ਟ੍ਰਿਪ ਹੈ ਉਹ ਜ਼ਰੂਰ ਲਗਾਇਓ ਜੀ ਅੱਛਾ ਜੀ ਓਕੇ ਓਕੇ